ਸਾਨੂੰ ਆਪਣੇ ਪਰਿਵਾਰ ਵਿੱਚ ਬਹੁਤ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਹਨ ਪਰਿਵਾਰ ਵਿੱਚ ਜਦੋਂ ਬੱਚੇ ਨੂੰ ਪੰਜਾਬ ਵਿੱਚ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਹਨਾਂ ਦਾ ਸਾਰਾ ਪਰਿਵਾਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਪਰਿਵਾਰ ਵਿੱਚ ਬੱਚੇ ਨਾਲ ਉਹਨਾਂ ਦੀ ਪੀੜ੍ਹੀ ਹੋਰ ਵਧ ਜਾਂਦੀ ਹੈ ਇਸ ਨਾਲ ਬੱਚ ਮਾਂ ਪਿਓ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਅਤੇ ਦਾਦੇ ਪੜਦਾਦੇ ਨੂੰ ਵੀ ਬਹੁਤ ਜ਼ਿਆਦਾ ਚਾਅ ਚੜ੍ਹ ਜਾਂਦਾ ਹੈ ਕਿਉਂਕਿ ਉਹਨਾਂ ਦੀ ਪੀੜ੍ਹੀ ਹੋਰ ਪੈਦਾ ਹੋ ਜਾਂਦੀ ਹੈ ਇਸ ਲਈ ਆਪ ਮਾਂ ਪਿਓ ਨੂੰ ਆਪਣੇ ਬੱਚੇ 'ਤੇ ਬਹੁਤ ਜ਼ਿਆਦਾ ਮਾਣ ਹੁੰਦਾ ਹੈ ਇਹ ਬੱਚੇ ਬੱਚੇ ਨੂੰ ਵੀ ਆਪਣੇ ਮਾਂ ਪਿਓ ਅਤੇ ਮਾਂ ਪਿਓ ਨਾਲ ਬਹੁਤ ਲਗਾਅ ਪਿਆਰ ਹੁੰਦਾ ਹੈ ਬੱ ਜਦੋਂ ਬੱਚਾ ਪੈਦਾ ਹੁੰਦਾ ਤਾਂ ਬੱਚਾ ਬੱਚੇ ਨੂੰ ਖੁਸ਼ੀ ਖੁਸ਼ੀ ਨਾਲ ਪਰਿਵਾਰ ਮਠਿਆਈਆਂ ਵੰਡਦਾ ਹੈ ਅਤੇ ਬੱਚਾ ਉਨਾ ਮਾਂ ਪਿਓ ਨੂੰ ਐਂ ਹੁੰਦਾ ਮੇਰਾ ਬੱਚਾ ਅੱਗੇ ਜਾਵੇ ਔਰ ਮੇਰਾ ਮਾਂ ਪਿਓ ਨਾਲ ਅਸੀਂ ਮੇਰੇ ਮਾਂ ਪਿਓ ਨੂੰ ਇਹ ਹੁੰਦਾ ਤੀ ਮੇਰਾ ਬੱਚਾ ਅੱਗੇ ਜਾਵੇ ਪੜ੍ਹਾਈ ਕਰੇ ਔਰ ਤਰੱਕੀ ਮਿਲੇ ਫਿਰ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਜਦੋਂ ਬੱਚੇ ਦਾ ਵਿਆਹ ਹੁੰਦਾ ਤਾਂ ਦਾਦੇ ਨੂੰ ਬਹੁਤ ਜ਼ਿਆਦਾ ਚਾਅ ਚੜ੍ਹ ਜਾਂਦਾ ਹੈ ਕਿਉਂਕਿ ਦਾਦੇ ਨੂੰ ਐਂ ਹੁੰਦਾ ਹੈ ਮੇਰੀ ਪੀੜ੍ਹੀ ਚੌਥੀ ਤਿਆਰ ਹੈ ਤੀਜੀ ਪੀੜ੍ਹੀ ਤਿਆਰ ਹੈ ਚੌਥੀ ਦੀ ਆਸ ਹੋ ਜੂ ਇਸ ਲਈ ਜਸ਼ਨ ਬਹੁਤ ਜ਼ਿਆਦਾ ਹੁੰਦੇ ਵਿਆਹ ਸ਼ਾਦੀਆਂ ਨਾਲ ਵਿਆਹ ਸ਼ਾਦੀਆਂ ਨਾਲ ਬਹੁਤ ਚਾਅ ਹੁੰਦਾ ਹੈ ਧੰਨਵਾਦ